ਨਮਸਤੇ ਨਮਸਤੇ ਸਰ ਜੀ ਹਾਂਜੀ ਰੀਤੂ ਬਾਲਾ ਢੇਸੀਆਂ ਤੋਂ ਬੋਲਦੀ ਹਾਂ ਬਲਕਿ ਸਾਡੇ ਪਿੰਡ ਵਿੱਚ ਕਿਸਾਨ ਬਹੁਤ ਜ਼ਿਆਦਾ ਪੈਲੀ ਬੰਨਾ ਵੀ ਬਹੁਤ ਜ਼ਿਆਦਾ ਹੈ ਅਤੇ ਕਿਸਾਨੀ ਮਲਕੀ ਕੰਮਕਾਰ ਬਹੁਤ ਜ਼ਿਆਦਾ ਆ ਜਿਹੜੀ ਅਸੀਂ ਫ਼ਸਲ ਲਗਾਉਂਦੇ ਹਾਂ ਅਤੇ ਫ਼ਸਲ ਸਾਡੀ ਕਈ ਕੀੜੇ ਮਕੌੜੇ ਖਾ ਜਾਂਦੇ ਆ ਲੱਗ ਜਾਂਦੇ ਆ ਫ਼ਸਲ ਸਾਡੀ ਖ਼ਰਾਬ ਹੋ ਜਾਂਦੀ ਆ ਅਤੇ ਉਹਨੂੰ ਮਲਕੀ ਠੀਕ ਕਰਨ ਵਾਸਤੇ ਅਸੀਂ ਠੀਕ ਕਰਨ ਵਾਸਤੇ ਅਸੀਂ ਮਲਕੀ ਸਵਾਹ ਸੁੱਟਦੇ ਹਾਂ ਜਾਂ ਨਿੰਮ ਦੇ ਮਲਕੀ ਘੋਲ ਘਾਲ ਜਿਹੜੇ ਸੁੱਟਦੇ ਆ ਕੋਈ ਦਵਾਈਆਂ ਲੈ ਕੇ ਫ਼ਸਲ ਵਿੱਚ ਸੁੱਟਦੇ ਹਾਂ ਔਰ ਮਲਕੀ ਕਈ ਚੀਜ਼ਾਂ ਦੀਆਂ ਦਵਾਈਆਂ ਬਣਾ ਕੇ ਅਸੀਂ ਵਿੱਚ ਪਾਉਂਦੇ ਹਾਂ ਕੁਛ ਬਾਜ਼ਾਰੋਂ ਲੈ ਕੇ ਪਾਉਂਦੇ ਹਾਂ ਕਿ ਜਿਹੜੀ ਫ਼ਸਲ ਖ਼ਰਾਬ ਹੋਣ ਦੀ ਆ ਅਤੇ ਉਹ ਦਵਾਈਆਂ ਨਾਲ ਮਲਕੀ ਸੁਆਹ ਨਾਲ ਦਵਾਈਆਂ ਨਾਲ ਕਿ ਠੀਕ ਹੋ ਜਾਏ ਕਿ ਫ਼ਸਲ ਸਾਡੀ ਖ਼ਰਾਬ ਨਾ ਹੋਏ ਅਤੇ ਫ਼ਸਲ ਸਾਡੀ ਠੀਕ ਠਾਕ ਮਲਕੀ ਰਹੇ ਅਤੇ ਕਿਸਾਨਾਂ ਦਾ ਕੰਮ ਵੀ ਮਲਕੀ ਠੀਕ ਹੈ ਜਿਹੜੀ ਫ਼ਸਲ ਖ਼ਰਾਬ ਹੋ ਜਾਂਦੀ ਹੈ ਅਤੇ ਮਲਕੀ ਸਾਨੂੰ ਬੜਾ ਦੁੱਖ ਲੱਗਦਾ ਆ ਇਸ ਕਰਕੇ ਹੈ ਅਸੀਂ ਫ਼ਸਲ ਬਚਾਉਣ ਵਾਸਤੇ ਮਲਕੀ ਸਾਨੂੰ ਦਵਾਈਆਂ ਦਾ ਜਾਂ ਸੁਆਹ ਦਾ ਬਲਕਿ ਕਿਸੇ ਦਾ ਵੀ ਉਪਯੋਗ ਕਰਨਾ ਪੈਂਦਾ ਆ ਕਿ ਫ਼ਸਲ ਸਾਡੀ ਠੀਕ ਨਿਕਲੇ ਠੀਕ ਠਾਕ ਰਹੇ ਠੀਕ ਹੈ ਸਰ ਜੀ